ਸਾਡੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ ਰਵਾਇਤੀ ਖੇਡਾਂ ਖੇਡੀਆਂ ਜਾਂਦੀਆਂ ਹਨ ਅੱਜ ਮੈਂ ਤੁਹਾਨੂੰ ਸਾਡੇ ਖੇਤਰ ਦੀ ਇੱਕ ਰਵਾਇਤੀ ਖੇਡ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਦਾ ਨਾਂ ਕਿ ਕਬੱਡੀ ਹੈ ਕਬੱਡੀ ਇੱਕ ਬਹੁਤ ਹੀ ਮਸ਼ਹੂਰ ਖੇਡ ਹੈ ਇਸ ਵਿੱਚ ਦੋਵੇਂ ਪਾਸੇ ਚਾਰ ਚਾਰ ਖਿਡਾਰੀ ਹੁੰਦੇ ਹਨ ਚਾਰ ਪਲੇਅਰ ਜਾਫੀ ਹੁੰਦੇ ਹਨ ਅਤੇ ਚਾਰ ਪਲੇਅਰ ਰੇਡਰ ਹੁੰਦੇ ਹਨ ਇਹ ਖੇਡ ਵਿੱਚ ਪੁਆਇੰਟ ਦੇ ਹਿਸਾਬ ਨਾਲ ਗੇਮ ਖੇਡੀ ਜਾਂਦੀ ਹੈ ਜਿਸ ਦੇ ਜ਼ਿਆਦਾ ਅੰਕ ਹੁੰਦੇ ਹਨ ਉਹ ਟੀਮ ਜਿੱਤ ਜਾਂਦੀ ਹੈ ਜਾਫੀ ਵਾਲਾ ਰੇਡਰ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਰੇਡਰ ਆਪਣੀ ਸੀਮਾ ਸੀਮਾ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਜੇਕਰ ਜਾਫੀ ਰੇਡਰ ਨੂੰ ਤੀਹ ਸਕਿੰਟ ਤੱਕ ਰੋਕ ਲੈਂਦਾ ਹੈ ਤਾਂ ਉਹ ਅੰਕ ਜਾਫੀ ਦੇ ਖੇਤ ਖਾਤੇ ਵਿੱਚ ਜਾਂਦਾ ਹੈ ਅਤੇ ਜੇਕਰ ਰੇਡਰ ਸੀਮਾ ਨੂੰ ਪਾਰ ਕਰ ਲੈਂਦਾ ਹੈ ਤਾਂ ਉਹ ਰੇਡਰ ਦੇ ਖਾਤੇ ਵਿੱਚ ਇੱਕ ਅੰਕ ਮਿਲ ਜਾਂਦਾ ਹੈ